ਵੈਲ ਮੈਂ ਇੱਕ ਬਿਬਲੀਫਾਈਲ ਪਰਸਨ ਹਾਂ ਜਿਸਨੂੰ ਕਿਤਾਬਾਂ ਪੜ੍ਹਨਾ ਅਤੇ ਕੋਈ ਵੀ ਨੋਲੇਜ਼ ਗੇਨ ਕਰਨ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਅਤੇ ਚਾਅ ਰਹਿੰਦਾ ਹੈ ਮੈਂ ਬਹੁਤ ਹੀ ਸਾਰੀਆਂ ਕਿਤਾਬ ਆਪਣੀ ਐਜੂਕੇਸ਼ਨਲ ਕਿਤਾਬਾਂ ਤੋਂ ਇਲਾਵਾ ਬਹੁਤ ਹੋਰ ਵੀ ਕਿਤਾਬਾਂ ਪੜ੍ਹੀਆਂ ਹਨ ਜਿਵੇਂ ਕਿ ਦਰ ਦਰਵਾਜ਼ੇ ਸ਼ਾਨ ਏ ਪੰਜਾਬ ਪੰਜਾਬੀ ਤੋਂ ਇਲਾਵਾ ਇੰਗਲਿਸ਼ ਬੁੱਕਸ ਵੀ ਮੈਨੂੰ ਪੜ੍ਹਨੀਆਂ ਬਹੁਤ ਹੀ ਜ਼ਿਆਦਾ ਵਧੀਆ ਲੱਗਦੀਆਂ ਹਨ ਅਤੇ ਮੈਨੂੰ ਮੈਗਜ਼ੀਨਜ ਬਲੋਗ ਅਖਬਾਰ ਪੜ੍ਹਦੇ ਬਹੁਤ ਹੀ ਵਧੀਆ ਲੱਗਦੇ ਹਨ ਜ ਕਿਉਂਕਿ ਜੋ ਇਨਫੋਰਮੇਸ਼ਨ ਨੋਲੇਜ ਅਤੇ ਲੋਕਾਂ ਦੇ ਆਰਟ ਜੋ ਕਿ ਮੈਗਜ਼ੀਨਾਂ ਅਖਬਾਰਾਂ ਵਿੱਚ ਛਪਦਾ ਹੈ ਉਸ ਬਾਰੇ ਨੋਲੇਜ ਮਿਲਦੀ ਹੈ ਅਤੇ ਕੀ ਕੀ ਲੋਕ ਕਿੱਦਾਂ ਕਿੱਦਾਂ ਸੋਚਦੇ ਹਨ ਕਿੱਦਾਂ ਕਿੱਦਾਂ ਆਪਣੇ ਵਲੋਗ ਪਾਉਂਦੇ ਹਨ ਇੱਕ ਡਿਫਰੈਂਟ ਪਰਸੈਪਸ਼ਨ ਪਾਉਂਦੇ ਨੇ ਜਿੱਦਾਂ ਮਤਲਬ ਹੁਣ ਗੂਗਲ ਦੇ ਉੱਤੇ ਕਈ ਪ੍ਰਕਾਰ ਦੇ ਵਲੋਗਸ ਇੱਕ ਟੋਪਿਕ ਦੇ ਉੱਤੇ ਕਈ ਪ੍ਰਕਾਰ ਦੇ ਵਲੋਗ ਮਿਲ ਜਾਂਦੇ ਹਨ ਤਾਂ ਉੱਥੋਂ ਆਪਾਂ ਨੂੰ ਅਲੱਗ ਅਲੱਗ ਲੋਕਾਂ ਦੇ ਪੁਆਇੰਟ ਔਫ ਵਿਊ ਬਾਰੇ ਪਤਾ ਲੱਗਦਾ ਹੈ ਅਲੱਗ ਅਲੱਗ ਇਨਫੋਰਮੇਸ਼ਨ ਗੇਨ ਹੁੰਦੀ ਆ ਸੋ ਮੈਨੂੰ ਬਹੁਤ ਹੀ ਜ਼ਿਆਦਾ ਮਤਲਬ ਕਿ ਪੜ੍ਹਨਾ ਪਸੰਦ ਹੈ ਮੈਂ ਬਲੋਗ ਮੈਗਜ਼ੀਨਸ ਅਖਬਾਰ ਕਿਤਾਬਾਂ ਸਾਰੀਆਂ ਕੁਛ ਪੜ੍ਹਨਾ ਬਹੁਤ ਐਕਸਾਈਟਮੈਂਟ ਅਤੇ ਬਹੁਤ ਹੀ ਜ਼ਿਆਦਾ ਚਾਅ ਨਾਲ ਪੜ੍ਹਦੀ ਹਾਂ